ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨਜੀਤ ਕੌਰ ਆ ਤੁਸੀਂ ਰਾਜਨ ਢਾਬੇ ਤੋਂ ਬੋਲਦੇ ਪਏ ਹੋ ਮੈਂ ਆਪਣੇ ਖਾਣ ਲਈ ਕੁਛ ਮੰਗਵਾਇਆ ਸੀ ਜਿਵੇਂ ਰੋਟੀ ਵਿੱਚ ਦਾਲ ਮੱਖਣੀ ਪਨੀਰ ਅਤੇ ਹੋਰ ਸਾਗ ਨਾਲ ਮੱਕੀ ਦੀ ਰੋਟੀ ਐਵੇਂ ਔਡਰ ਕੀਤਾ ਸੀਗਾ ਅਤੇ ਉਹਦੀ ਮੈਂ ਔਨਲਾਈਨ ਪੇਮੈਂਟ ਕਰਤੀ ਸੀਗੀ ਹੁਣ ਮੈਨੂੰ ਕਿਸੇ ਕੰਮ ਕਰਕੇ ਜ਼ਰੂਰੀ ਜਾਣਾ ਪੈ ਰਿਹਾ ਜਿਸ ਕਰਕੇ ਮੈਂ ਔਡਰ ਨੂੰ ਕੈਂਸਲ ਕਰਨਾ ਚਾਹੁੰਦੀ ਹਾਂ ਅਤੇ ਮੈਂ ਔਨਲਾਈਨ ਪੇਮੈਂਟ ਕਰਤੀ ਸੀ ਉਹ ਮੇਰੀ ਕਿਰਪਾ ਕਰਕੇ ਵਾਪਸ ਕੀਤੀ ਜਾਵੇ ਅੱਗੇ ਵੀ ਮੈਂ ਤੁਹਾਡੀ ਤੁਹਾਡੇ ਢਾਬੇ ਤੋਂ ਜੋ ਵੀ ਮੰਗਾਉਣਾ ਹੁੰਦਾ ਆ ਉਹ ਮੰਗਾਉਂਦੀ ਹਾਂ ਅਤੇ ਤੁਹਾਡੇ ਢਾਬੇ ਦਾ ਬਹੁਤ ਹੀ ਵਧੀਆ ਟੇਸਟ ਆ ਅਤੇ ਹਰ ਵਾਰੀ ਤੁਹਾਡੇ ਤੋਂ ਹੀ ਮੰਗਾਈ ਦਾ ਜਦੋਂ ਵੀ ਕੋਈ ਗੈਸਟ ਆਉਂਦੇ ਆ ਜਦੋਂ ਵੀ ਕੋਈ ਵੀ ਕੰਮ ਜਾਂ ਸਾਡੇ ਘਰ ਕੋਈ ਫੰਕਸ਼ਨ ਵਗੈਰਾ ਹੁੰਦਾ ਹੈ ਤੁਹਾਡੇ ਤੋਂ ਹੀ ਸਾਰੀ ਕੈਟਨ ਵਗੈਰਾ ਕੀਤੀ ਜਾਂਦੀ ਆ ਅਤੇ ਹੁਣ ਤੁਸੀਂ ਪਲੀਜ ਮੇਰਾ ਜਿਹੜਾ ਆਹ ਵਾਲਾ ਇੱਕ ਔਡਰ ਕੈਂਸਲ ਕਰ ਦਿਉ ਅਤੇ ਮੇਰੀ ਪੇਮੈਂਟ ਆ ਜਿਹੜੀ ਵਾਪਿਸ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ